ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਅਰਥਚਾਰੇ ਦਾ ਵਿਕਾਸ ਹੋਇਆ ਹੈ ਜਿਵੇਂ ਇੰਡਸਟਰੀਆਂ ਹੋਣ ਕਰਕੇ ਲੋਕਾਂ ਕੋਲ ਕਾਫੀ ਪੈਸਾ ਜੋ ਹੈ ਆਇਆ ਹੈ ਪੈਸਾ ਹੋਣ ਕਰਕੇ ਉਹ ਜੇਬ ਵਿੱਚ ਪੈਸੇ ਰੱਖਣ ਦੀ ਬਜਾਏ ਗੂਗਲ ਪੇ ਅਤੇ ਹੋਰ ਜੋ ਇੰਟਰਨੈਟ ਬੈਂਕਿੰਗ ਐਪਸ ਹੈ ਉਹਨਾਂ ਨਾਲ ਆਪਣਾ ਪੈਸਾ ਜੋ ਟਰਾਂਸਫਰ ਜਾਂ ਡੈਬਿਟਡ ਜਾਂ ਕ੍ਰੈਡਿਟਡ ਕਰਨਾ ਚਾਹੁੰਦੇ ਨੇ ਅਤੇ ਕਾਫੀ ਇਸ ਨਾਲ ਇਸ ਖੇਤਰ ਵਿੱਚ ਸੁਧਾਰ ਆਇਆ ਹੈ